ਮੈਨੂੰ ਚਿੱਤਰਕਾਰੀ ਕਰਨਾ ਬਹੁਤ ਪਸੰਦ ਹੈ ਮੈਂ ਕਿਸੇ ਇੱਕ ਮੁਕਾਬਲੇ ਵਿੱਚ ਪ੍ਰਦਰਸ਼ਨੀ ਦੇ ਵਿੱਚ ਚਿੱਤਰਕਲਾ ਕੀਤੀ ਸੀ ਉਹਦੇ ਵਿੱਚ ਮੈਨੂੰ ਬਹੁਤ ਵਧੀਆ ਅ ਕਮੈਂਟ ਮਿਲੇ ਕਿ ਤੁਸੀਂ ਬਹੁਤ ਵਧੀਆ ਬਣਾਇਆ ਹੈ ਮੈਂ ਉਹਦੇ ਵਿੱਚ ਇੱਕ ਸੀਨਰੀ ਬਣਾਈ ਸੀਗੀ ਬਹੁਤ ਵਧੀਆ ਲੱਗੀ ਅਤੇ ਉਹਦੇ ਵਿੱਚ ਬਹੁਤ ਜਣਿਆਂ ਨੇ ਕਿਹਾ ਕੀ ਬਹੁਤ ਵਧੀਆ ਤੁਸੀਂ ਬਣਾਈ ਹੈ ਫਿਰ ਏਹ ਇਹ ਤੋਂ ਅੱਗੇ ਮੈਨੂੰ ਇੱਦਾਂ ਹੀ ਹੋਂਸਲਾ ਮਿਲਦਾ ਗਿਆ ਅਤੇ ਮੈਂ ਬਹੁਤ ਵਧੀਆ ਵਧੀਆ ਚਿੱਤਰਕਾਰੀਆਂ ਕਰਨ ਲੱਗ ਗਈ ਅਤੇ ਫਿਰ ਮੈਨੂੰ ਛੋਟੀ ਹੁੰਦੀ ਵੀ ਮੈਂ ਸਕੂਲ 'ਚ ਸਕੂਲ ਵਿੱਚ ਮੈਨੂੰ ਬਹੁਤ ਮੇਰੇ ਮੈਡਮ ਟੀਚਰ ਕਹਿੰਦੇ ਸੀ ਕਿ ਤੂੰ ਬਹੁਤ ਵਧੀਆ ਬਹੁਤ ਵਧੀਆ ਕਰਦੀ ਹੈਂ ਚਿੱਤਰਕਲਾ ਬਹੁਤ ਵਧੀਆ ਬਣਾਉਂਦੀ ਹੈ ਅਤੇ ਮੈਂ ਉਨ੍ਹਾਂ ਕੋਲੋਂ ਪ੍ਰਭਾਵਿਤ ਹੋ ਕੇ ਤਾਂ ਮੈਂ ਬਹੁਤ ਸਾਰੀਆਂ ਪ੍ਰੀਖਿਆਵਾਂ ਦਿੱਤੀਆਂ ਚਿੱਤਰਕਾਰੀ ਦੀਆਂ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਚਿੱਤਰਕਲਾ ਚਿੱਤਰਕਲਾ ਬਣਾਉਣਾ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਸਾਰੀਆਂ ਪੇਂਟਿੰਗ ਬਣਾਈਆਂ ਮੈਂ ਜਿਹਨਾਂ ਵਿੱਚ ਮੈਨੂੰ ਬੜਾ ਸਾਰਿਆਂ ਦਾ ਸਹਿਯੋਗ ਮਿਲਿਆ ਕਿ ਤੁਸੀਂ ਬਹੁਤ ਵਧੀਆ ਬਣਾਉਂਦੇ ਹੋ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਮੈਂ ਚਿੱਤਰਕਾਰੀ ਕਰਦੀ ਹਾਂ ਤੇ